ਭਾਰਤੀ ਸਿੱਖਿਆ ਪ੍ਰਣਾਲੀ ਵਧੀਆ ਹੋਣੀ ਚਾਹੀਦੀ ਹੈ ਸੋ ਵਧੀਆ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ ਹੈ ਵਧੀਆ ਸਿੱਖਿਆ ਦੇਣੀ ਚਾਹੀਦੀ ਹੈ ਟੀਚਰਜ ਟੀਚਰਸ ਨੂੰ ਚਾਹੀਦਾ ਹੈ ਕਿ ਵਧੀਆ ਤਰੀਕੇ ਨਾਲ ਬੱਚੇ ਨੂੰ ਕੰਪੇਅਰ ਕਰਨ ਪਰਪੇਅਰ ਕਰਨ ਤਾਂ ਜੋ ਉਸਨੂੰ ਵੱਧ ਤੋਂ ਵੱਧ ਨੌਲੇਜ ਆ ਸਕੇ ਅਤੇ ਪ੍ਰਾਈਵੇਟ ਸਕੂਲ ਅਤੇ ਸਰਕਾਰੀ ਸਕੂਲ ਦੇ ਬੱਚਿਆਂ 'ਚ ਬਹੁਤ ਜ਼ਿਆਦਾ ਡਿਫਰੈਂਸ ਹੁੰਦਾ ਹੈ ਪ੍ਰਾਈਵੇਟ ਸਕੂਲ ਦੇ ਬੱਚਿਆਂ ਦੀ ਗਾਈਡੈਂਸ ਇੰਨੀ ਜ਼ਿਆਦਾ ਵਧੀਆ ਹੁੰਦੀ ਹੈ ਕਿ ਵੀ ਉਹ ਆਪਣੀ ਇੰਟਰੋਡਕਸ਼ਨ ਖੁਦ ਤੋਂ ਹੀ ਛੋਟੇ ਜਿਹੇ ਹੁੰਦੇ ਤੋਂ ਹੀ ਦੇ ਸਕਦੇ ਹਨ ਅਤੇ ਉਸਨੂੰ ਉਹਨਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਗਾਈਡ ਕਰ ਟੀਚਰਸ ਬਹੁਤ ਵਧੀਆ ਗਾਈਡ ਕਰਦੇ ਹਨ ਅਤੇ ਉਹ ਆਪਣੀ ਇੰਟਰੋ ਬਹੁਤ ਵਧੀਆ ਤਰੀਕੇ ਨਾਲ ਦਿੰਦੇ ਹਨ ਅਤੇ ਉਹਨਾਂ ਨੂੰ ਮਤਲਬ ਕਿ ਇਹ ਚਾਹੀਦਾ ਹੈ ਕਿ ਪ੍ਰੈਕਟੀਕਲ ਦੇ ਥੈਟੀਕਲ ਦੇ ਨਾਲ ਨਾਲ ਪ੍ਰੈਕਟੀਕਲ ਵੀ ਹੋਣਾ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਅੱਜ ਕੱਲ੍ਹ ਬੱਚੇ ਪ੍ਰੈਕਟੀਕਲ ਦੇ ਨਾਲ ਜ਼ਿਆਦਾ ਜ ਵਧੀਆ ਪ੍ਰੈਕਟੀਕਲ ਦੇ ਨਾਲ ਜ਼ਿਆਦਾ ਸਿੱਖਦੇ ਹਨ ਅਤੇ ਥਰੈਟੀਕਲ ਨਾਲ ਘੱਟ ਜਾਂ ਤਾਂ ਜੋ ਆਪਣੇ ਤਰੀਕੇ ਨਾਲ ਕਰ ਸਕਣ ਆਪਣੇ ਹੱਥੀਂ ਕਰਕੇ ਬੱਚਾ ਜ਼ਿਆਦਾ ਪਰਪੇਅਰ ਹੁੰਦਾ ਹੈ ਅਤੇ ਉਹਨਾਂ ਨੂੰ ਟੀਚਰਸ ਨੂੰ ਚਾਹੀਦਾ ਹੈ ਅਤੇ ਉਹਨਾਂ ਨੂੰ ਨੌਲੇਜ ਉਹਦੇ ਬਾਰੇ ਜ਼ਿਆਦਾ ਦੱਸਣਾ ਵਧੀਆ ਦੱਸਣਾ ਤਾਂ ਜਾਂ ਤਾਂ ਜੋ ਉਹਨਾਂ ਨੂੰ ਨੌਲੇਜ ਜ਼ਿਆਦਾ ਹੋ ਸਕੇ ਅਤੇ ਉਹਨਾਂ ਨੂੰ ਵਧੀਆ ਤਰੀਕੇ ਨਾਲ ਗੱਲਬਾਤ ਕਰਨਾ ਸਿਖਾਉਣਾ ਅਤੇ ਰੂਲ ਰੈਗੂਲੇਸ਼ਨ ਵਿੱਚ ਰਹਿਣਾ ਸਿਖਾਉਣਾ ਚਾਹੀਦਾ ਹੈ